ਅੱਜ ਕੱਲ੍ਹ ਜਿਹੜੀਆਂ ਬਹੁਤ ਜ਼ਿਆਦਾ ਟੈਕਨੋਲੋਜੀ ਆ ਗਈ ਹੈ ਜਦੋਂ ਐਬੂਲੈਂਸ 'ਚ ਹੁੰਦੇ ਹਾਂ ਉਦੋਂ ਆਪਾਂ ਪੇਸ਼ੈਂਟ ਦਾ ਹਾਰਟ ਲੈਵਲ ਚੈੱਕ ਕਰ ਸਕਦੇ ਹਾਂ ਕਿ ਉਹਦਾ ਹਾਰਟ ਰੇਟ ਸਹੀ ਹੈ ਕਿਵੇਂ ਹੈਗਾ ਜਾਂ ਘੱਟ ਵੱਧ ਹੈਗਾ ਜਾਂ ਉਹਦੇ ਸਰੀਰ 'ਚ ਕੀ ਹੁੰਦਾ ਪਿਆ ਹੈਗਾ ਆਪਾਂ ਇਹ ਅੱਜ ਕੱਲ੍ਹ ਐਬੂਲੈਂਸ 'ਚ ਹੀ ਚੈਕ ਕਰ ਸਕਦੇ ਹਾਂ ਤਾਂ ਕਿ ਜਿੰਨੀ ਦੇਰ ਤੱਕ ਆਪਾਂ ਹੋਸਪਿਟਲ 'ਚ ਪਹੁੰਚੀਏ ਆਪਾਂ ਨੂੰ ਡੋਕਟਰ ਬਾਰੇ ਆਪਾਂ ਡੋਕਟਰ ਡਾਕਟਰ ਨੂੰ ਆਪਣੇ ਬਾਰੇ ਸਾਰੀ ਇਨਫੋਰਮੇਸ਼ਨ ਪਤਾ ਹੋਵੇ ਅਤੇ ਆਪਣਾ ਟਾਈਮ ਬਚੇ ਅਤੇ ਡਾਕਟਰ ਆਪਣੇ ਉੱਤੇ ਉਸੀ ਟਾਈਮ 'ਤੇ ਇਲਾਜ ਸ਼ੁਰੂ ਕਰ ਸਕੇ ਹੋਸਪਿਟਲ ਵਿੱਚ ਵੀ ਬਹੁਤ ਜ਼ਿਆਦਾ ਸੁਵਿਧਾਵਾਂ ਆ ਗਈਆਂ ਬਹੁਤ ਜ਼ਿਆਦਾ ਮਸ਼ੀਨਾਂ ਆ ਗਈਆਂ ਜਿਵੇਂ ਹਾਰਟ ਰੇਟ ਮਸ਼ੀਨ ਹੋ ਗਈ ਵਗੈਰਾ ਵਗੈਰਾ ਵਗੈਰਾ ਜਿਵੇਂ ਖੂਨ ਚੂਸਨ ਵਾਲੀ ਮਸ਼ੀਨ ਹੈਗੀ ਆ ਓਪਰੇਸ਼ਨ ਦੇ ਦੌਰਾਨ ਖੂਨ ਚੂਸ ਲੈਂਦੀ ਹੈ ਤਾਂ ਡਾਕਟਰ ਨੂੰ ਜਿਹੜਾ ਹੈਗਾ ਚੰਗਾ ਵਿਊ ਮਿਲਦਾ ਹੈਗਾ ਬੈਡ ਹੈਗੇ ਆ ਅਕੋਮੋਡੇਸ਼ਨ ਅੱਜ ਕੱਲ੍ਹ ਵਧੀਆ ਹੈਗੀ ਹੈ ਬੈਡ ਅਜ ਕਲ੍ਹ ਬਹੁਤ ਜ਼ਿਆਦਾ ਇੱਥੇ ਜਿਵੇਂ ਫਾਰਮਿੰਗ 'ਚ ਫਾਰਮਿੰਗ 'ਚ ਅੱਜ ਕੱਲ੍ਹ ਤਾਂ ਬਹੁਤ ਜ਼ਿਆਦਾ ਸੌਖਾ ਹੋ ਗਿਆ ਜਿਵੇਂ ਟਰੈਕਟਰ ਹੁੰਦੇ ਹੈਗੇ ਹੈ ਨਾ ਟਰੈਕਟਰ ਹੈਗੇ ਆ ਉਹਨਾਂ ਨਾਲ ਜਿਹੜੀ ਖੇਤੀ ਜਿਹੜੀ ਆ ਬਹੁਤ ਜ਼ਿਆਦਾ ਸੌਖੀ ਹੋ ਗਈ ਹੈ ਉਹਨਾਂ ਨਾਲ ਆਪਣੀ ਜਿਹੜੀ ਖੇਤੀ ਦੀ ਉਮਦ ਜਿਹੜੀ ਹੈਗੀ ਬਹੁਤ ਜ਼ਿਆਦਾ ਹੋ ਗਈ ਹੈਗੀ ਹੈ ਆਪਾਂ ਛੇਤੀ ਜਿਹੜਾ ਹੈਗਾ ਹੈ ਲਾ ਸਕਦੇ ਹਾਂ ਨਾਲ ਬੀਜ਼ ਸਕਦੇ ਹਾਂ ਛੇਤੀ ਜਿਹੜਾ ਹੈਗਾ ਉਹ ਨਾ ਕੰਮ ਕਰ ਸਕਦੇ ਹਾਂ ਬਹੁਤ ਜ਼ਿਆਦਾ ਛੇਤੀ ਕੰਮ ਕਰ ਸਕਦੇ ਹਾਂ ਅੱਜ ਕਲ੍ਹ ਅਲੱਗ ਅਲੱਗ ਮਸ਼ੀਨਾਂ ਨੇ ਆਪਣਾ ਜਿਹੜਾ ਕੰਮ ਜਿਹੜਾ ਹੈ ਸੌਖਾ ਕਰਤਾ ਝੋਨੇ ਦੇ ਜਿਹੜੀ ਮਸ਼ੀਨ ਹੈਗੀ ਹੈ ਉਹਦੇ 'ਚ ਆਪਾਂ ਮਸ਼ੀਨ ਨੂੰ ਉਹਦੇ 'ਚ ਝੋਨਾ ਪਾ ਦਿੰਦੇ ਹਾਂ ਆਪਣੇ ਜਿਹੜੇ ਦਾਣੇ ਅਲੱਗ ਕਰ ਦਿੰਦਾ ਹੈਗਾ ਜਿਹੜਾ ਦੂਜਾ ਵੇਸਟ ਮਟੀਰੀਅਲ ਹੁੰਦਾ ਉਹ ਅਲਗ ਕਰ ਦਿੰਦਾ ਹੈ ਵੈਸੇ ਵੇਸਟ ਮਟੀਰੀਅਲ ਵੀ ਬਹੁਤ ਜ਼ਿਆਦਾ ਕਮ ਆਉਂਦਾ ਬਾਅਦ 'ਚ ਕਈ ਲੋਕਾਂ ਦੇ ਹੋਮ ਮੇਡ ਅਲੱਗ ਕਰ ਦਿੰਦਾ ਹੈਗਾ ਹਲ ਉਹ ਚੁਗਣ ਵਾਲੀ ਜ਼ਮੀਨ ਤੋਂ ਕੱਢਣ ਵਾਲੀ ਮਸ਼ੀਨ ਹੈਗੀ ਹੈ ਉਹ ਜ਼ਮੀਨ ਤੋਂ ਆਲੂ ਕੱਢੀ ਜਾਂਦੀ ਹੈਗੀ ਆਪਣੇ ਆਪ ਹੀ ਆਪਣਾ ਕੰਮ ਜਿਹੜਾ ਬਹੁਤ ਸੌਖਾ ਹੋ ਜਾਂਦਾ ਐਸੇ ਲਹਿਜਾ ਆਪਾਂ ਨੂੰ ਲੇਬਰ ਦੀ ਜਿਹੜੀ ਕੋਸਟ ਹੈਗੀ ਆ ਉਹ ਘਟਦੀ ਆ ਮਸ਼ੀਨਾਂ ਜਿਹੜੀਆਂ ਹੈਗੀਆਂ ਐਕਸਪੇਨਸੀਵ ਵੀ ਹੈਗੀਆਂ ਵੈਸੇ ਤਾਂ ਬਹੁਤ ਜ਼ਿਆਦਾ ਲੇਕਿਨ ਅੱਜ ਕੱਲ੍ਹ ਇਹਦੇ ਵਰਤੋਂ ਤੋਂ ਬਿਨ੍ਹਾਂ ਸਰਦਾ ਨਹੀਂ ਹੈਗਾ ਇਹਦੇ ਵਰਤੋ ਨਾਲ ਜਿਹੜਾ ਕੰਮ ਜਿਹੜਾ ਛੇਤੀ ਹੁੰਦਾ ਪਿਆ ਛੇਤੀ ਕੰਮ ਹੁੰਦਾ ਪਿਆ ਹੈਗਾ ਆਪਣਾ